ਹੈਲੋ ਹਾਂਜੀ ਸਰ ਤੁਸੀਂ ਆਪਣਾ ਬੀਐਸਐਲ ਬਰਨਾਲਾ ਤੋਂ ਗੱਲ ਕਰਦੇ ਹੋ ਜੀ ਅੱਛਾ ਜੀ ਹਾਂਜੀ ਸਰ ਮੈਂ ਨਾ ਇੱਕ ਬੇਨਤੀ ਕਰਨਾ ਹੀ ਚਾਹੁੰਦਾ ਸੀਗਾ ਮੇਰਾ ਲੈਂਡਲਾਈਨ ਨੰਬਰ ਹੈਗਾ ਨਾ ਜਿਹੜਾ ਬੀਐਸਐਲ ਦਾ ਲੱਗਿਆ ਹੋਇਆ ਹੈਗਾ ਉਹਨਾ ਕਈ ਵਾਰ ਨਾ ਬਿਲ ਭਰ ਭੁੱਲ ਜਾਂਦਾ ਮੈਨੂੰ ਧਿਆਨ ਨੀ ਨਾ ਰਹਿੰਦਾ ਗਾ ਕੰਮ ਹੀ ਬਾਹਲੇ ਹੈਗੇ ਤਾਂ ਉਹ ਫਿਰ ਸਾਨੂੰ ਨਾ ਜਿਹੜਾ ਇੱਕ ਦਾ ਪੈਂਡਿੰਗ ਚਾਰਜਿਜ ਵਗੈਰਾ ਵਾਹਵਾ ਕੁਛ ਦੇਣਾ ਪੈਂਦਾ ਹੈਗਾ ਤੁਸੀਂ ਮੇਰਾ ਨਾ ਪਲੀਜ਼ ਆ ਖਾਤਾ ਚੈੱਕ ਕਰੋ ਮੇਰਾ ਨਾ ਅਕਾਊਂਟ ਨੰਬਰ ਵੀ ਨਾਲ ਵੈਸੇ ਜੋੜਿਆ ਹੋਇਆ ਵੀ ਆਟੋ ਪੇ ਲਾ ਦਿਓ ਜਿਹੜਾ ਮੇਰਾ ਬਿਲ ਨਾ ਆਟੋ ਪੇ ਆਪਣੇ ਆਪ ਕੱਟਿਆ ਜਾਇਆ ਕਰੇ ਤਾਂ ਕਿਉਂਕਿ ਮੈਂ ਭੁੱਲ ਜਾਂਦਾ ਤਾਂ ਉਹਦੇ ਲਈ ਮੈਨੂੰ ਪਲਾਂਟੀ ਪੈਂਦੀ ਹੈ ਅਤੇ ਮੈਨੂੰ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਨੇ ਪਲੀਜ਼ ਕਈ ਵਾਰੀ ਨਾ ਤੁਸੀਂ ਨਾ ਇਹਨੂੰ ਅਤੇ ਚੈੱਕ ਕਰੋ ਵੀ ਆਟੋ ਪੇ ਹੈਗਾ ਜਾਂ ਨਹੀਂ ਹੈਗਾ ਗਾ ਅੱਛਾ ਕਰ ਰਹੇ ਹੋ ਸਰ ਅੱਛਾ ਅੱਛਾ ਅੱਛਾ ਠੀਕ ਆ ਜੀ ਸਰ ਹੈ ਨਹੀਂ ਗਾ ਜੀ ਸਰ ਮੈਂ ਕਰਵਾਇਆ ਸੀ ਚਲੋ ਮੈਂ ਐਪਲੀਕੇਸ਼ਨ ਦੇ ਕੇ ਗਿਆ ਸੀ ਸਰ ਜੇ ਤੁਸੀਂ ਇੱਦਾਂ ਕਰ ਸਕਦੇ ਹੋ ਅਤੇ ਐਂ ਲਗਾ ਸਕਦੇ ਹੋ ਅਤੇ ਮੇਰੀ ਕਾਲ ਦੇ ਉੱਪਰ ਹੀ ਲਗਾ ਦਿਓ ਜੇ ਤੁਹਾਨੂੰ ਮੈਂ ਐਪਲੀਕੇਸ਼ਨ ਦੁਬਾਰਾ ਦੇ ਕੇ ਜਾਵਾਂ ਤਾਂ ਮੈਂ ਦੁਬਾਰਾ ਦੇ ਜੂਗਾ ਸਰ ਠੀਕ ਹੈ ਤਾਂ ਕਿ ਜਿਹੜਾ ਮੇਰਾ ਬਿੱਲ ਹੈ ਨਾ ਸਮੇਂ ਸਿਰ ਕੱਟਿਆ ਜਾਇਆ ਕਰੇ ਐਵੇਂ ਦਿੱਕਤਾਂ ਨਾਲ ਤਾਂ ਡਿਪਾਰਟਮੈਂਟ ਨੂੰ ਦਿੱਕਤ ਨਾਲੇ ਮੈਨੂੰ ਦਿੱਕਤ ਹੈ ਨਾ ਅਤੇ ਸਰ ਬਸ ਠੀਕ ਹੈ ਸਰ ਮੈਂ ਨਾ ਹਾਂ ਓਕੇ ਓਕੇ ਹਾਂਜੀ ਮੈਂ ਨਾ ਐਪਲੀਕੇਸ਼ਨ ਦੇ ਕੇ ਜਾਉਂਗਾ ਅੱਜ ਸ਼ਾਮ ਨੂੰ ਓਕੇ ਸਰ ਥੈਂਕ ਯੂ ਸਰ